ਚੌਦ੍ਹਾਂ ਜਨਵਰੀ ਦੋ ਹਜ਼ਾਰ ਦੋ ਸਤਾਈ ਜੂਨ ਦੋ ਹਜ਼ਾਰ ਪੰਜ ਇੱਕ ਨਵੰਬਰ ਦੋ ਹਜ਼ਾਰ ਨੌ ਪੰਜ ਜਨਵਰੀ ਦੋ ਹਜ਼ਾਰ ਤੇਰ੍ਹਾਂ ਛੇ ਜਨਵਰੀ ਦੋ ਹਜ਼ਾਰ ਇੱਕ